ਸਤਿ ਸ਼੍ਰੀ ਅਕਾਲ ਜੀ

ਹਾਂਜੀ ਮੈਡਮ ਦੇਖੋ ਮੈਡਮ ਮੈਂ ਮਾਨਸਾ ਦੀ ਵਸਨੀਕ ਹਾਂ ਜੀ ਅਤੇ ਪਹਿਲੇ ਸਭ ਤੋਂ ਵੱਡੀ ਸਮੱਸਿਆ ਤਾਂ ਦੇਖੋ ਜਦੋਂ ਬਾਰਿਸ਼ਾਂ ਹੋਣ ਜਿਵੇਂ ਮਾਨਸੂਨ ਦਾ ਚੱਲ ਰਿਹਾ ਹੈ ਨਾ ਵੀ ਮਾਨਸੂਨ ਸ਼ੁਰੂ ਹੋ ਜਾਣਾ ਹੁਣ ਸਭ ਤੋਂ ਬਾਹਲੀ ਵੱਡੀ ਸਮੱਸਿਆ ਤਾਂ ਜਿਵੇਂ ਮੀਂਹ ਕਰਕੇ ਨਾ ਸਾਨੂੰ ਪਾਣੀ ਦੀ ਬਹੁਤ ਰਹਿੰਦੀ ਹੈਗੀ ਵੀ ਜਿਵੇਂ ਸੜਕਾਂ 'ਤੇ ਸਾਰਾ ਪਾਣੀ ਜੰਮ ਜਾਂਦਾ ਨਾਲੀਆਂ ਦਾ ਪਾਣੀ ਮਿਕਸ ਹੋ ਜਾਂਦਾ ਨਾ ਤੁਰਨ ਫਿਰਨ ਰਹਿੰਦੇ ਹਾਂ ਟੋਏ ਬੁਰਾ ਹਾਲ ਮਤਲਬ ਮੱਖੀ ਮੱਛਰ ਬੈਠਦਾ ਸੌ ਬਿਮਾਰੀਆਂ ਫੈਲਦੀਆਂ ਨੇ ਅਤੇ ਜੇ ਪੂਰਾ ਪਾਣੀ ਦਾ ਜਿਹੜਾ ਨਿਕਾਸ ਹੈ ਉਹ ਮੁਕੰਮਲ ਨਹੀਂ ਹੈਗਾ ਸ਼ਹਿਰ ਦੇ ਵਿੱਚ ਤੁਸੀਂ ਇੱਧਰ ਵੀ ਧਿਆਨ ਦਿਓ ਹੈ ਨਾ ਦੂਜੀ ਗੱਲ ਜਿਹੜਾ ਹਾਂਜੀ ਹਾਂਜੀ ਮੈਮ ਇਸ ਤੋਂ ਇਸ ਤੋਂ ਬਿਨਾ ਮੈਮ ਜਿਵੇਂ ਮੈਂ ਸਿੱਖਿਆ ਦੇ ਮਾਮਲੇ 'ਚ ਦੇਖ ਲਉ ਤੁਸੀਂ ਜਿਵੇਂ ਹੈ ਨਾ ਕੁੜੀਆਂ ਨੂੰ ਤੁਸੀਂ ਦੇਖੋ ਮਾਨਸਾ ਸ਼ਹਿਰ ਕਿੰਨਾ ਵੱਡਾ ਹੈ ਨਾ ਕਿੰਨੇ ਪਿੰਡ ਨੇ ਇਹਦੇ ਵਿੱਚ ਹੁਣ ਸਰਕਾਰੀ ਕਾਲਜ ਮਾਨਸਾ ਦੇ ਵਿੱਚ ਤੁਸੀਂ ਦੇਖ ਲਉ ਕੁੜੀਆਂ ਦਾ ਜਿਵੇਂ ਇੱਕੋ ਹੀ ਹੈ ਮਾਤਾ ਸੁੰਦਰੀ ਕੋਲੇਜ ਜਾਂ ਫਿਰ ਸਰਕਾਰੀ ਕੋਲਜ ਹੈਗਾ ਨਹਿਰੂ ਕੋਲੇਜ ਹੈ ਨਾ ਹੁਣ ਆਪਣੀ ਕਿੰਨੀ ਜਨਸੰਖਿਆ ਹੈਗੀ ਹੈ ਨਾ ਬੱਚੇ ਕਿੱਧਰ ਜਾਣ ਸੀਟਾਂ ਹੀ ਬਹੁਤ ਥੋੜ੍ਹੀਆਂ ਹੁੰਦੀਆਂ ਨੇ ਬੱਚਿਆਂ ਨੂੰ ਬਾਹਰ ਜਾਣਾ ਪੈਂਦਾ ਗਾ ਉੱਤੋਂ ਦੀ ਬੱਸਾਂ ਦਾ ਸਾਰਾ ਜਿਹੜਾ ਆਉਣ ਜਾਣ ਆ ਉਹ ਵੀ ਗੱਲ ਇੱਕ ਆਮ ਬੰਦੇ ਕੋਲ ਤਾਂ ਐਨੇ ਪੈਸੇ ਵੀ ਨਹੀਂ ਹੁੰਦੇ ਹੈਗੇ ਕਿ ਉਹ ਐਨਾ ਗੁਜ਼ਾਰਾ ਕਰ ਸਕੇ ਦੂਜੀ ਗੱਲ ਕੀ ਹੈ ਕੁੜੀਆਂ ਲਈ ਤਾਂ ਦੇਖੋ ਸਹੂਲਤ ਹੈਗੀ ਓਈ ਹੈ ਜਿਵੇਂ ਵੀ ਇਹ ਇਕੱਲਾ ਫਿਰ ਕੁੜੀਆਂ ਦਾ ਹੀ ਕੋਲਜ ਜਿਹੜਾ ਸਰਕਾਰੀ ਹੈ ਮੁੰਡਿਆਂ ਦਾ ਵੀ ਮੁੰਡੇ ਕਿੱਧਰ ਜਾਣ ਦੇਖੋ ਹੈ ਨਾ ਅਤੇ ਉਸ ਤੋਂ ਉਸ ਤੋਂ ਬਗੈਰ ਮੈਮ ਇੱਕ ਨਾ ਜਿਵੇਂ ਇੱਧਰ ਚੋਰੀ ਕੇਸ ਬਹੁਤ ਜ਼ਿਆਦਾ ਹੁੰਦੇ ਨੇ ਮਤਲਬ ਵੀ ਜਿਵੇਂ ਨਸ਼ੇ ਪੱਤੇ ਵਾਲੇ ਹੋ ਗਏ ਜਾਂ ਕੁਛ ਹੋਰ ਲੋਕ ਜਿਨ੍ਹਾਂ ਨੇ ਕੁਛ ਕਰਨਾ ਨਹੀਂ ਹੈ ਨਾ ਜਿਵੇਂ ਹੁਣ ਰਾਹ ਜਾਂਦਾ ਬੰਦਾ ਸੇਫ ਨਹੀਂ ਹੈਗਾ ਸੇਫਟੀ ਨੂੰ ਲੈ ਕੇ ਵੀ ਥੋੜ੍ਹਾ ਤੁਸੀਂ ਪੁਲਿਸ ਜਿਹੜਾ ਪ੍ਰਬੰਧ ਆ ਉਹਨਾਂ ਨੂੰ ਵੀ ਕਹੋ ਤੁਸੀਂ ਥੋੜ੍ਹਾ ਜਿਹਾ

ਹਾਂਜੀ ਅਤੇ ਹਾਂਜੀ ਮੈਮ ਜਿਵੇਂ ਹੁਣ ਤੁਸੀਂ ਜਿਵੇਂ ਹੁਣ ਹੁਣ ਤਾਂ ਆਪਾਂ ਔਨਲਾਈਨ ਵੀ ਕੰਪਲੇਨ ਕਰ ਦਿੰਦੇ ਹੈਗੇ ਪਰ ਜੇ ਹੁਣ ਜਿਹੜਾ ਬੰਦਾ ਹੁਣ ਐਡੀ ਦੂਰ ਬੈਠਾ ਗਾ ਜਾਂ ਜਿਹਦੇ ਕੋਲ ਸਾਧਨ ਨਹੀਂ ਹੈਗਾ ਉੱਥੇ ਸ਼ਿਕਾਇਤ ਕਰਨ ਦਾ ਹੈ ਨਾ ਜਾ ਜਾ ਕੇ ਜੇ ਆਪਾਂ ਔਨਲਾਈਨ ਵੀ ਕਰਦੇ ਹਾਂ ਤਾਂ ਮੈਮ ਔਨਲਾਈਨ ਵੀ ਕੀ ਹੈਗਾ ਫੋਨ ਨਹੀਂ ਚੱਕਦੇ ਹੈਗੇ ਪੁਲਸ ਵਾਲੇ ਸਾਨੂੰ ਬਹੁਤ ਸਮੱਸਿਆ ਆਉਂਦੀ ਹੈ ਵੀ ਅਸੀਂ ਸ਼ਿਕਾਇਤ ਕਿਵੇਂ ਦਰਜ ਕਰੀਏ ਨਾ ਉੱਥੇ ਕੋਈ ਸੁਣਦਾ ਸਾਡੀ ਨਾ ਹੀ ਫੋਨ 'ਤੇ ਜੇ ਕਰਦੇ ਹਾਂ ਔਨਲਾਈਨ ਕਰਦੇ ਹਾਂ ਸ਼ਿਕਾਇਤ ਨਾ ਉੱਥੇ ਕੋਈ ਫੋਨ ਚੱਕਦਾ ਗਾ ਸਾਨੂੰ ਬਹੁਤ ਸਮੱਸਿਆਵਾਂ ਆਉਂਦੀਆਂ ਨੇ ਐਵੇਂ ਹਾ ਹਾਂਜੀ ਮੈਮ ਮੈਮ ਇੱਕ ਵ ਉਹਦਾ ਬ ਵਜ਼ੀਫੇ ਦਾ ਵੀ ਸੀਗਾ ਬੱਚਿਆਂ ਨੂੰ ਵਜ਼ੀਫਾ ਨਹੀਂ ਮਿਲ ਰਿਹਾ ਕੋਲਜਾਂ ਦੇ ਵਿੱਚ ਜਿਹੜੇ ਐੱਸ ਸੀ ਬੱਚੇ ਨੇ ਉਹਨਾਂ ਨੂੰ ਵਜ਼ੀਫਾ ਨਹੀਂ ਮਿਲਿਆ ਹੈਗਾ ਫੰਡ ਹੀ ਨਹੀਂ ਪਾਸ ਹੁੰਦਾ ਹੈਗਾ ਬੱਚਿਆਂ ਤੱਕ ਪਹੁੰਚਦੇ ਹੀ ਨਹੀਂ ਪੈਸੇ ਹਾਂਜੀ ਠੀਕ ਹੈ ਠੀਕ ਹੈ ਜੀ